ਆਟੋਮੈਟਿਕ ਹਾਂਜੀ ਗੂਗਲ ਜੋ ਗੂਗਲ ਦੀ ਐਪ ਗੂਗਲ ਡਿਕਸ਼ਨਰੀ ਦੀ ਉਹ ਜ਼ਰੂਰ ਮੈ ਯੂਜ਼ ਕਰਦਾ ਮੈਨੂੰ ਬਹੁਤ ਜ਼ਰੂਰਤ ਪੈਂਦੀ ਕਈ ਵਾਰ ਮੈਨੂੰ ਕੋਈ ਇੰਗਲਿਸ਼ ਦੇ ਕੁਝ ਵਰਡ ਨਹੀਂ ਪਤਾ ਹੁੰਦੇ ਤਾਂ ਮੈਂ ਉਸੇ ਐਪ ਦਾ ਜੂਸ ਯੂਸ ਕਰਦਾ ਬਾਕੀ ਹੋਰ ਤਾਂ ਮੈਂ ਕੋਈ ਅਨੁਵਾਦ ਕਰਨ ਲਈ ਹੋਰ ਅੱਜ ਕੱਲ੍ਹ ਬਹੁਤ ਮੈਨੂੰ ਪਤਾ ਚੱਲਦੀਆਂ ਨੇ ਜਾਂ ਏ ਆਈ ਜਨਰੇਟਰ ਐਪ ਹੈਗੇ ਨੇ ਕੁਛ ਜਿਹਦੇ ਨਾਲ ਤੁਸੀਂ ਹੋਰ ਇੱਕ ਭਾਸ਼ਾ 'ਚ ਬੋਲ ਕੇ ਦੂਸਰੀ ਭਾਸ਼ਾ ਦੇ ਵਿੱਚ ਅਨੁਵਾਦ ਕਰ ਸਕਦੇ ਹੋ ਬਟ ਮੈਂ ਤੁਹਾਨੂੰ ਪਤਾ ਪੰਜਾਬ 'ਚ ਜ਼ਿਆਦਾਤਰ ਅਜੇ ਤੱਕ ਤਾਂ ਮੈਨੂੰ ਇਹ ਕੋਈ ਲੋੜ ਪਈ ਕਿਉਂਕਿ ਜੇ ਮੈਂ ਬਾਹਰ ਜਾਵਾਂ ਕਿਸੇ ਜਾਂ ਕਿਸੇ ਹੋਰ ਸਟੇਟ 'ਚ ਕੇਰਲਾ ਵਗੈਰਾ ਤਾਂ ਉੱਥੇ ਹੀ ਭਾਸ਼ਾ ਅਲੱਗ ਹੁੰਦੀ ਉੱਥੇ ਜੂਸ ਉੱਥੇ ਦੀ ਵਰਤੋਂ ਕੀਤੀ ਜਾਂਦੀ ਹੈ ਬਟ ਮੇਰੇ ਵਰਗੇ ਹੁਣ ਉੱਥੇ ਹਾਲੇ ਜਾ ਨਹੀਂ ਪਾ ਰਿਹਾ ਤਾਂ ਮੈਂ ਤਾਂ ਜਾ ਨਹੀਂ ਪਾ ਰਿਹਾ ਪਰ ਜਦੋਂ ਹਾਂ ਜਦੋਂ ਮੇਰਾ ਗੇੜਾ ਲੱਗੂਗਾ ਤਾਂ ਮੈਂ ਜ਼ਰੂਰ ਇਹੋ ਜਿਹੀ ਐਪ ਮੈਨੂੰ ਪਤਾ ਯੂਸ ਕਰਨੀ ਹੀ ਪੈਣੀ ਮੈਨੂੰ ਵਰਤੋਂ ਦੀ ਦੀ ਲੋੜ ਪੈ ਹੀ ਜਾਂਦੀ ਹੈ ਪਰ ਹਾਲੇ ਮੈਂ ਇਹੋ ਜਿਹੀ ਕੁਛ ਨਹੀਂ ਕਰੀ ਬਸ ਗੂਗਲ ਡਿਕਸ਼ਨਰੀ ਦੀ ਕਰੀ ਹੈ ਮੈਂ ਕਿਉਂ ਉਹ ਵੀ ਮੈਨੂੰ ਮੀਨਿੰਗ ਵਗੈਰਾ ਕੋਈ ਵਰਡ ਇਹੋ ਜਿਹੇ ਆ ਜਾਂਦੇ ਕੋਈ ਸ਼ਬਦ ਇਹੋ ਜਿਹੇ ਹੁੰਦੇ ਨੇ ਇੰਗਲਿਸ਼ ਦੇ ਜਿਹਨਾਂ ਦਾ ਅਨੁਵਾਦ ਕਰਨਾ ਥੋੜ੍ਹਾ ਮੁਸ਼ਕਿਲ ਹੁੰਦਾ ਤਾਂ ਉਸ ਐਪ ਦਾ ਹੀ ਯੂਸ ਕਰਦਾ